ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਗੱਲ ਕਰ ਰਹੇ ਹਾਂ ਕਿ ਆਪਾਂ ਜਿਹੜੀਆਂ ਕਿਹੜੀਆਂ ਕਿਹੜੀਆਂ ਇਨਡੋਰ ਗੇਮ ਜਿਹੜਾ ਵਾ ਉਹਨਾਂ ਦਾ ਆਨੰਦ ਮਾਣਦੇ ਹਾਂ ਆਮ ਘਰਾਂ ਵਿੱਚ ਖੇਡੀਆਂ ਜਾਂਦੀਆਂ ਜੇਕਰ ਵੇਖੋ ਜੀ ਆਪਾਂ ਗੱਲ ਕਰਦੇ ਹਾਂ ਲੂਡੋ ਦੀ ਕੈਰਮ ਦੀ ਇਹ ਅੱਜ ਕੱਲ੍ਹ ਦੀਆਂ ਮੋਡਰਨ ਖੇਡਾਂ ਵਾ ਠੀਕ ਹੈ ਇਹਨਾਂ ਦੀ ਜਿਹੜੀ ਆ ਉਹ ਵਰਤੋਂ ਬੱਚਿਆਂ ਦੁਆਰਾ ਵੀ ਕੀਤੀ ਜਾਂਦੀ ਵੱਡੇ ਵੀ ਬੈਠ ਕੇ ਫਰੀ ਟਾਈਮ 'ਚ ਜਿਹੜਾ ਵਾ ਉਹ ਇਹਨਾਂ ਖੇਡਾਂ ਨਾਲ ਆਨੰਦ ਮਾਣਦੇ ਆ ਪਰ ਜੇ ਆਪਾਂ ਥੋੜ੍ਹੀ ਜਿਹੀ ਪੁਰਾਤਨ ਗੱਲ ਕਰੀਏ ਤਾਂ ਪੁਰਾਤਨ ਸਮੇਂ 'ਚ ਜਿਹੜਾ ਸੀਗਾ ਬੱਚੇ ਇੰਡੋਰ ਗੇਮ ਜਿਨ੍ਹਾਂ ਨੂੰ ਆਪਾਂ ਕਹਿੰਦੇ ਉਹ ਸੀਗੀਆਂ ਉਹਨਾਂ ਦੀਆਂ ਉਹ ਰੋੜੇ ਅਤੇ ਬੋਲ ਗੇਂਦ ਜਿਹਨੂੰ ਕਹਿ ਦਿੰਦੇ ਉਹਦੇ ਨਾਲ ਅੰਦਰੇ ਅੰਦਰ ਬਹਿ ਕੇ ਖੇਡਦੇ ਹੁੰਦੇ ਸੀ ਬਹੁਤ ਦੂਜਾ ਆਪਣਾ ਰੋੜੇ ਖੇਡਣਾ ਕੁੜੀਆਂ ਨੇ ਇਕੱਠੇ ਹੋ ਕੇ ਬੋਲ ਦੇ ਨਾਲ ਆਪਣੀ ਆਪਣੀ ਬੋਲ ਉਛਾਲ ਕੇ ਅਤੇ ਰੋੜੇ ਚੁੱਕਣੇ ਉਹ ਉਹਨਾਂ ਦੀ ਗੇਮ ਹੁੰਦੀ ਸੀ ਅਤੇ ਇਸ ਤੋਂ ਬਾਅਦ ਜਿਹੜਾ ਹੋਰ ਇਹਨਾਂ ਦੀਆਂ ਗੇਮਾਂ ਹੁੰਦੀਆਂ ਸੀਗੀਆਂ ਪਰਚੀਆਂ ਖੇਡਦੇ ਹੁੰਦੇ ਸੀ ਇੱਕ ਗਰੁੱਪ ਬਣਾ ਕੇ ਬਹਿ ਜਾਣਾ ਅਤੇ ਵੱਖ ਵੱਖ ਜਿਹੜੀਆ ਪਰਚੀਆਂ ਬਣਾ ਲੈਣੀਆਂ ਰਾਜੇ ਵਜ਼ੀਰ ਚੋਰ ਸਿਪਾਹੀ ਹੈ ਨਾ ਅਤੇ ਦੂਜੇ ਕਈ ਤਰ੍ਹਾਂ ਦੇ ਜਿਹੜੇ ਇਹਦੇ ਵਿੱਚ ਹੋਰ ਵੀ ਪਰਚੀਆਂ ਹੁੰਦੀਆਂ ਸੀ ਪਰਚੀ ਤੋਰਨ ਵਾਲੀਆਂ ਉਹ ਖੇਡੀਆਂ ਜਾਂਦੀਆਂ ਸੀ ਅਤੇ ਅੱਜ ਕੱਲ੍ਹ ਇਹਨਾਂ ਦੀ ਜਗ੍ਹਾ ਜਿਹੜਾ ਵਾ ਉਹ ਲੂਡੋ ਨੇ ਕੈਰਮ ਨੇ ਸਾ ਸੱਪ ਅਤੇ ਪੌੜੀ ਨੇ ਇਸ ਤਰ੍ਹਾਂ ਦੇ ਇਹੋ ਜਿਹੀਆਂ ਗੇਮਾਂ ਨੇ ਜਿਹੜੀ ਆ ਉਹ ਲੈ ਲਈ ਹੈ ਅਤੇ ਲੂਡੋ ਜਿਹੜੀ ਆ ਉਹ ਕਾਫ਼ੀ ਬੱਚੇ ਜਿਹੜਾ ਵਾ ਉਹਨੂੰ ਖੇਡਣਾ ਪਸੰਦ ਕਰਦੇ ਆ ਕਿਉਂਕਿ ਇੱਕ ਜਗ੍ਹਾ 'ਤੇ ਬੈਠ ਕੇ ਇਹ ਇੱਕ ਬੋਰਡ 'ਤੇ ਖੇਡੀ ਜਾਂਦੀ ਆ ਇਹ ਜਿਹੜੀ ਹੈ ਆਸਾਨੀ ਨਾਲ ਬਾਜ਼ਾਰ ਵਿੱਚੋਂ ਉਹ ਸਸਤੀ ਕੀਮਤ 'ਤੇ ਜਿਹੜੀ ਹੈ ਉਹ ਮਿਲ ਜਾਂਦੀ ਆ ਅਤੇ ਬੱਚੇ ਇਹਦਾ ਅਨੰਦ ਵੀ ਉਠਾਉਂਦੇ ਆ ਅਤੇ ਜੇਕਰ ਕਿਸੇ ਕੋਲੋਂ ਇਹ ਬਜ਼ਾਰੋਂ ਨਹੀਂ ਖਰੀਦੀ ਜਾਂਦੀ ਅੱਜ ਕੱਲ੍ਹ ਮੋਬਾਇਲ ਫੋਨ ਦਾ ਜਮਾਨਾ ਵਾ ਅਤੇ ਮੋਬਾਇਲ ਫੋਨ ਘਰ ਘਰ ਵਿੱਚ ਹੈਗੇ ਆ ਅਤੇ ਬੱਚੇ ਵੱਖ ਵੱਖ ਥਾਵਾਂ 'ਚ ਆਪਣੇ ਵੱਖਰੇ ਵੱਖਰੇ ਕਵਾਂ ਘਰਾਂ 'ਚ ਬੈਠ ਕੇ ਅਤੇ ਕਨੈਕਟ ਕਰਕੇ ਇੰਟਰਨੈਟ ਰਾਹੀਂ ਅਤੇ ਅੰਦਰੇ ਬੈਠ ਕੇ ਗੇਮ ਜਿਹੜੀ ਆ ਉਹ ਖੇਡ ਲੈਂਦੇ ਜਦੋਂ ਲਾਕਡਾਊਨ ਹੋਇਆ ਸੀ ਉਦੋਂ ਇਹ ਗੇਮਾਂ ਕਾਫ਼ੀ ਜਿਹੜੀਆਂ ਵਾ ਉਹ ਚੱਲੀਆਂ ਸੀ ਠੀਕ ਹੈ ਅਤੇ ਇਸ ਲਈ ਵੱਖ ਵੱਖ ਥਾਵਾਂ 'ਤੇ ਜਿਹੜਾ ਵਾ ਕੋਈ ਕੋਈ ਤਰ੍ਹਾਂ ਦੀ ਗੇਮ ਖੇਡਣੀ ਪਸੰਦ ਕਰਦਾ ਕੋਈ ਕੋਈ ਕੋਈ ਲੂਡੋ ਖੇਡੀ ਜਾਂਦਾ ਕੋਈ ਕੈਰਮ ਬੋਰਡ ਖੇਡੀ ਜਾਂਦਾ ਕੋਈ ਸੱਪ ਅਤੇ ਪੌੜੀ ਖੇਡੀ ਜਾਂਦਾ ਠੀਕ ਹੈ ਇਹਨਾਂ ਨੇ ਜਿਹੜਾ ਵਾ ਲੋਕਾਂ ਨੇ ਮਨੋਰੰਜਨ ਨੂੰ ਜਿਹੜਾ ਸੀ ਉਹ ਕਾਫ਼ੀ ਜਿਹੜਾ ਵਾ ਉਹ ਕੀਤਾ ਸੀਗਾ ਅਤੇ ਅੱਜ ਵੀ ਜਿਹੜਾ ਵਾ ਇਹ ਖੇਡਾਂ ਜਿਹੜੀਆਂ ਵਾ ਉਹ ਬੱਚਿਆਂ ਦੁਆਰਾ ਖੇਡੀਆਂ ਜਾਂਦੀਆਂ ਵਾ ਕਿਉਂਕਿ ਜਿਹੜੇ ਆ ਵਿਹੜੇ ਛੋਟੇ ਹੋ ਗਏ ਆ ਘਰ ਭੀੜੇ ਹੋ ਗਏ ਆ ਗਰਾਊਂਡਾਂ ਘੱਟ ਆ ਅਤੇ ਬੱਚੇ ਬਾਹਰ ਜਾ ਕੇ ਖੇਡਣਾ ਚਾਹੁੰਦੇ ਹੋਏ ਵੀ ਨਹੀਂ ਖੇਡ ਸਕਦੇ ਉਹਨਾਂ ਨੂੰ ਅੰਦਰੇ ਹੀ ਬਹਿ ਕੇ ਖੇਡਣਾ ਪੈਂਦਾ ਵਾ ਅਤੇ ਇਸ ਕਰਕੇ ਇਹਨਾਂ ਗੇਮਾਂ ਦਾ ਜਿਹੜਾ ਮਹੱਤਵ ਆ ਅੱਜ ਦੇ ਜਮਾਨੇ ਵਿੱਚ ਉਹਨੂੰ ਆਪਾਂ ਨਜ਼ਰ ਅੰਦਾਜ ਜਿਹੜਾ ਨਹੀਂ ਕਰ ਸਕਦੇ ਧੰਨਵਾਦ